ਬਾਗਬਾਨੀ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ ਮੈਂ ਬਚਪਨ ਤੋਂ ਹੀ ਬਹੁਤ ਜ਼ਿਆਦਾ ਰੰਗ ਬਿਰੰਗੇ ਫੁੱਲਾਂ ਨੂੰ ਹਰਿਆਲੀ ਨੂੰ ਪਸੰਦ ਕਰਦੀ ਸੀ ਪਰ ਜ਼ਿਆਦਾ ਬਾਗਬਾਨੀ ਉਗਾਉਣ ਦਾ ਸ਼ੌਕ ਮੈਨੂੰ ਮੇਰੇ ਇੱਕ ਦੋਸਤ ਦੇ ਘਰ ਤੋਂ ਹੋਇਆ ਜਦ ਮੈਂ ਇੱਕ ਵਾਰ ਆਪਣੇ ਦੋਸਤ ਨੂੰ ਮਿਲਣ ਉਹਨਾਂ ਦੇ ਘਰ ਗਈ ਤਾਂ ਉਹਨਾਂ ਦੇ ਘਰ ਵਿੱਚ ਮੈਂ ਬਗੀਚੀ ਨੂੰ ਦੇਖਿਆ ਬਹੁਤ ਸੁੰਦਰ ਸੀ ਬਹੁਤ ਤਰ੍ਹਾਂ ਤਰ੍ਹਾਂ ਦੇ ਫਲਾਵਰ ਸੀਗੇ ਛੋਟੇ ਛੋਟਾ ਹਰਾ ਘਾਹ ਸੀ ਬਹੁਤ ਸੋਹਣੀ ਸੀ ਬਾਗ ਬਗੀਚੀ ਉਹਨਾਂ ਦੀ ਤਾਂ ਮੈਨੂੰ ਦੇਖ ਕੇ ਉਹਦੇ ਵੱਲ ਬਹੁਤ ਜ਼ਿਆਦਾ ਸ਼ੌਕ ਪੈਦਾ ਹੋਇਆ ਤਾਂ ਮੈਂ ਵੀ ਘਰ ਆ ਕੇ ਆਪਣੇ ਘਰ ਬਾਗਬਾਨੀ ਨੂੰ ਸ਼ੁਰੂ ਕੀਤਾ ਮਤਲਬ ਵੱਖ ਵੱਖ ਤਰ੍ਹਾਂ ਦੇ ਫਲਾਵਰ ਮੰਗਵਾਏ ਪੋਟ ਮੰਗਵਾਏ ਫੁੱਲਦਾਨ ਮੰਗਵਾਏ ਅਤੇ ਰੱਖੇ ਫਿਰ ਮੈਂ ਕਈ ਮਤਲਬ ਗਮਲੇ ਮੰਗਵਾ ਕੇ ਰੰਗ ਬਿਰੰਗੇ ਫੁੱਲਾਂ ਦੇ ਰੱਖੇ ਅਤੇ ਮੈਂ ਕਈਆਂ ਕਈ ਜਿਹੜੇ ਪੋਟ ਸੀਗੇ ਕਈ ਜਿਹੜੇ ਗਮਲੇ ਸੀਗੇ ਉਹ ਮੈਂ ਆਪਣੇ ਘਰ ਦੇ ਵੇਸਟ ਮਟੀਰੀਅਲ ਜਿੱਦਾਂ ਡੱਬੇ ਹੋ ਗਏ ਬੋਤਲਸ ਹੋ ਗਈਆਂ ਉਹਨਾਂ ਨੂੰ ਕੱਟ ਕੇ ਕਲਰ ਕਰਕੇ ਪੇਂਟ ਕਰਕੇ ਉਹਨਾਂ ਦੇ ਵਿੱਚ ਫਲਾਵਰ ਉਗਾਏ ਅਤੇ ਮੈਂ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਬਾਗਬਾਨੀ ਨੂੰ ਸ਼ੁਰੂ ਕੀਤਾ ਅਤੇ ਇਹ ਮੈਨੂੰ ਪ੍ਰੇਰਨਾ ਆਪਣੇ ਦੋਸਤ ਦੇ ਘਰ ਤੋਂ ਮਿਲੀ